ਮੱਛੀਆਂ ਫੜਨ ਦੇ ਵਿੱਚ ਬਹੁਤ ਅਜਿਹੇ ਮੁੱਦੇ ਹਨ ਜੋ ਵਾਤਾਵਰਣ ਦੀ ਸੰਭਾਲ ਨਾਲ਼ ਜੁੜੇ ਹੋਏ ਹਨ ਕਿਉਂਕਿ ਕਈ ਮੱਛੀਆਂ ਦੀਆਂ ਇਵੇਂ ਦੀਆਂ ਨਸਲਾਂ ਹਨ ਜੋ ਕਿ ਲੁਪਤ ਹੋਣ ਵਾਲ਼ੀਆਂ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਉਹਨਾਂ ਨਸਲਾਂ ਨੂੰ ਨਾ ਹੀ ਪਕੜੀਏ ਜਿਹੜੀਆਂ ਖਤਰੇ ਦੀ ਕਗਾਰ 'ਤੇ ਹਨ ਕਿਉਂਕਿ ਅਸੀਂ ਭਵਿੱਖ ਲਈ ਵੀ ਉਹਨਾਂ ਦਾ ਪ੍ਰਜਨਨ ਕਰਾ ਕੇ ਉਹਦੀ ਅੱਗੇ ਜਨਸੰਖਿਆ ਵਧਾਉਣੀ ਹੈ ਜੇਕਰ ਅਸੀਂ ਉਹਨਾਂ ਨੂੰ ਫੜ ਲਵਾਂਗੇ ਤਾਂ ਸਾਡੇ ਕੋਲ ਉਸ ਜਾਤੀ ਦਾ ਲੁਪਤ ਹੋਣ ਦਾ ਖਤਰਾ ਬਣਿਆ ਹੀ ਰਹੇਗਾ ਅਤੇ ਇਸ ਬਾਰੇ ਚਿੰਤਾਵਾਂ ਇਹ ਵੀ ਹਨ ਕਿ ਮੱਛੀਆਂ ਦੇ ਖਤਮ ਹੋਣ ਨਾਲ਼ ਜਲ ਸਰੋਤ ਨੂੰ ਬਹੁਤ ਡੂੰਘਾ ਪ੍ਰਭਾਵ ਪਵੇਗਾ ਅਤੇ ਮੱਛੀਆਂ ਦੇ ਫੜਨ ਦੇ ਨਾਲ਼ ਇੱਕ ਹੋਰ ਦਿੱਕਤ ਇਹ ਵੀ ਹੈ ਕਿ ਕਈ ਜਹਾਜ਼ ਹੁੰਦੇ ਹਨ ਜੋ ਸਮੁੰਦਰਾਂ ਵਿੱਚੋਂ ਲੰਘਦੇ ਹਨ ਉਹਨਾਂ ਦੇ ਤੇਲ ਲੀਕ ਹੋਣ ਦੇ ਨਾਲ਼ ਹੀ ਜਲ ਜੀਵਨ ਨੂੰ ਕਾਫੀ ਪ੍ਰਭਾਵ ਪੈਂਦਾ ਹੈ ਕਿਉਂਕਿ ਤੇਲ ਦੀ ਪਰਤ ਜੰਮ ਜਾਣ ਦੇ ਨਾਲ਼ ਜੋ ਰੋਸ਼ਨੀ ਹੈ ਉਹ ਸਹੀ ਤਰੀਕੇ ਨਾਲ਼ ਉਹਨਾਂ ਤੱਕ ਨਹੀਂ ਪਹੁੰਚਦੀ ਅਤੇ ਔਕਸੀਜਨ ਦਾ ਵੀ ਡਾਵਾਂ ਡੋਲ ਪੱਧਰ ਹੋ ਜਾਂਦਾ ਹੈ ਅਤੇ ਜੇਕਰ ਦੇਖੀਏ ਪਾਣੀ ਪ੍ਰਦੂਸ਼ਣ ਤਾਂ ਪਾਣੀ ਪ੍ਰਦੂਸ਼ਣ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿੰਨਾ ਵੀ ਫੈਕਟਰੀਆਂ ਦਾ ਬਚਿਆ ਖੁਚਿਆ ਸਮਾਨ ਹੈ ਓਹ ਪਾਣੀ ਵਿੱਚ ਸਿੱਟ ਦਿੱਤਾ ਜਾਂਦਾ ਹੈ ਜੋ ਕਿ ਪਾਣੀ ਨੂੰ ਜ਼ਹਿਰੀਲਾ ਬਣਾਉਂਦਾ ਹੈ ਕਾਰਖਾਨਿਆਂ ਤੋਂ ਇਲਾਵਾ ਕਈ ਮਰੇ ਹੋਏ ਪਸ਼ੂ ਜਾਂ ਕੂੜਾ ਕਰਕਟ ਵੀ ਪਾਣੀ ਵਿੱਚ ਸੁੱਟ ਦਿੰਦੇ ਹਨ ਇਸ ਨਾਲ਼ ਦੇਖਣ ਨੂੰ ਮਿਲਿਆ ਹੈ ਕਿ ਪਿਛਲੇ ਦਸ ਪੰਦਰ੍ਹਾਂ ਸਾਲਾਂ ਤੋਂ ਹੀ ਪਾਣੀ ਦੀ ਸ਼ੁੱਧਤਾ ਦਿਨ ਬ ਦਿਨ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਜੋ ਧਰਤੀ ਹੇਠਲਾ ਪਾਣੀ ਹੈ ਉਸਦਾ ਲੈਵਲ ਹੋਰ ਨੀਵਾਂ ਹੋਈ ਜਾ ਰਿਹਾ ਹੈ ਅਤੇ ਜੋ ਪਾਣੀ ਨਿਕਲਦਾ ਹੈ ਓਹ ਪੀਣ ਲਈ ਬਿਲਕੁਲ ਸਹੀ ਨਹੀਂ ਹੈ ਇਹ ਸਾਡੇ ਹੀ ਕੰਮਾਂ ਕਰਕੇ ਹੋਇਆ ਹੈ ਕਿਉਂਕਿ ਅਸੀਂ ਪਾਣੀ ਦੀ ਸੰਭਾਲ ਨਹੀਂ ਕਰਦੇ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਰਹਿੰਦੇ ਹਾਂ ਸੋ ਸਾਨੂੰ ਚਾਹੀਦਾ ਹੈ ਕਿ ਪਾਣੀ ਦਾ ਪ੍ਰਦੂਸ਼ਣ ਰੋਕਿਆ ਜਾਵੇ ਤਾਂ ਜੋ ਜਲ ਜੀਵਨ ਵੀ ਖਤਰੇ ਵਿੱਚ ਨਾ ਪਵੇ